ਨਾਚ ਸ਼ਬਦ ਮਨੁੱਖ ਦੀਆਂ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਕਰਨ ਵਾਲੀ ਕਲਾ ਪੱਤਰੀ ਦਾ ਨਾਮ ਹੈ ਜੋ ਸੋ ਲੋਕ ਨਾਚ ਤੋਂ ਭਾਵ ਉਹ ਨਾਚ ਹੈ ਜਿਸ ਨੂੰ ਆਮ ਲੋਕ ਆਪਣੀ ਖੁਸ਼ੀ ਵਲਵਲੇ ਅਤੇ ਉਤਸ਼ਾਹ ਨੂੰ ਉਜਾਗਰ ਕਰਨ ਲਈ ਆਮ ਹੀ ਵਰਤ ਲੈਂਦੇ ਹਨ ਭਾਰਤ ਵਿੱਚ ਕਈ ਤਰ੍ਹਾਂ ਦੇ ਨਾਚ ਮਸ਼ਹੂਰ ਹਨ ਭਾਰਤ ਵਿੱਚ ਹਰ ਰਾਜ ਦਾ ਆਪਣਾ ਆਪਣਾ ਲੋਕ ਨਾਚ ਹੈ ਇਸੇ ਹੁਣ ਵਿੱਚ ਨਾਚ ਵੀ ਕਾਫ਼ੀ ਪਾਪੋਲਰ ਭਰਪੂਰ ਹੋ ਰਹੇ ਹਨ ਜਿਵੇਂ ਕਥਕ ਕਾਫ਼ੀ ਮਸ਼ਹੂਰ ਹਨ ਸਾਡੇ ਪੰਜਾਬ ਵਿੱਚ ਭੰਗੜਾ ਅਤੇ ਗਿੱਧਾ ਕਿੱਕਲੀ ਕਿੱਕਲੀ ਸੰਮੀ ਲੁੱਡੀ ਆਦਿ ਲੋਕ ਨਾਚ ਹਨ